ਪੰਛੀਆਂ ਵਾਸਤੇ ਅਸੀਂ ਆਪਣੇ ਵਿਹੜੇ ਦੇ ਵਿੱਚ ਕਾਫੀ ਬੂਟੇ ਲਗਾਏ ਹੋਏ ਆ ਜੋ ਕਿ ਬੜੇ ਸੰਘਣੇ ਆ ਅਤੇ ਪੰਛੀਆਂ ਨੂੰ ਰਾਤ ਨੂੰ ਉਹਨਾਂ ਨੂੰ ਬਹੁਤ ਚੰਗਾ ਲੱਗਦਾ ਹੈ ਉਹ ਆਉਣ ਕੇ ਇੱਥੇ ਬਹਿੰਦੇ ਆ ਅਤੇ ਉਹਨਾਂ ਵਾਸਤੇ ਅਸੀਂ ਆਲ੍ਹਣੇ ਵੀ ਬਣਾ ਕੇ ਰੱਖੇ ਹੋਏ ਆ ਅਤੇ ਉਹਨਾਂ ਦੇ ਦਿਨ ਵ ਦਿਨ ਦੇ ਟਾਈਮ ਦੇ ਵਿੱਚ ਅਸੀਂ ਉਹਨਾਂ ਨੂੰ ਕਈ ਵਾਰ ਦਾਣੇ ਜਾਂ ਉਹਨਾਂ ਦੇ ਮਨ ਪਸੰਦੀਦਾ ਫਰੂਟ ਜਿਹੜਾ ਫਲ ਆ ਉਹ ਪਾ ਦਿੰਦੇ ਹਾਂ ਅਤੇ ਕੁਛ ਜਦੋਂ ਗਰਮੀ ਜ਼ਿਆਦਾ ਹੁੰਦੀ ਹੈ ਭਾਂਡੇ ਵਿੱਚ ਪਾ ਕੇ ਅਤੇ ਅਸੀਂ ਉਹਨਾਂ ਨੂੰ ਪਾਣੀ ਵੀ ਰੱਖਦੇ ਹਾਂ ਜਿਹਦੇ ਨਾਲ ਕਿ ਪੰਛੀ ਦੂਰੋਂ ਵੀ ਚੱਲ ਕੇ ਉਹ ਸਾਡੇ ਘਰ ਵਿੱਚ ਆ ਜਾਂਦੇ ਆ ਅਤੇ ਬਹੁਤ ਸੋਹਣੇ ਲੱਗਦੇ ਆ ਅਸੀਂ ਜਿੱਥੋਂ ਤੱਕ ਹੋ ਸਕਦਾ ਉਹਨਾਂ ਨੂੰ ਮਾਰਦੇ ਨਹੀਂ ਹਾਂ ਉਹਨਾਂ ਨੂੰ ਉਡਾਉਂਦੇ ਨਹੀਂ ਹਾਂ ਅਤੇ ਉਹਨਾਂ ਨੂੰ ਇੱਥੇ ਸਾਡੇ ਘਰ ਵਿੱਚ ਰਹਿਣਾ ਬਹੁਤ ਪਸੰਦ ਹੈ